ਗਆਂਢ ਵਿੱਚ ਸੈਰ ਕਰਦੇ ਸਮੇਂ ਕੂੜਾਦਾਨ ਦੇਖ ਕੇ ਭਰੇ ਹੀ ਰਹਿੰਦੇ ਹਨ ਦੇਖਦੇ ਹੀ ਬੜਾ ਹੀ ਮਨ ਦੁਖੀ ਹੁੰਦਾ ਹੈ ਵੀ ਕੋਈ ਸਫਾਈ ਨਹੀਂ ਸਫਾਈ ਵਲ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਕੋਈ ਸਫਾਈ ਕਰਮਚਾਰੀ ਵੀ ਨਹੀਂ ਆ ਰਿਹਾ ਅਸੀਂ ਇਹ ਬਹੁਤ ਪਰੇਸ਼ਾਨ ਹੁੰਦੇ ਹਾਂ ਇੰਨੀ ਬਦਬੂ ਆਉਂਦੀ ਹੈ ਕੁਝ ਖਾਣਾ ਪੀਣਾ ਵੀ ਹਰਾਮ ਹੋ ਗਿਆ ਹੈ ਬੱਚੇ ਵੀ ਨਹੀਂ ਖੇਡ ਸਕਦੇ ਪਾਣੀ ਵਿੱਚ ਵੀ ਸਮੈਲ ਆਉਂਦੀ ਹੈ ਮੈਂ ਸੋਚਦਾ ਹਾਂ ਕਿ ਕੂੜਾ ਚੁਕਵਾਉਣ ਲਈ ਇੱਕ ਫੋ ਕਰਮਚਾਰੀ ਦੇ ਆਫਿਸ ਵਿੱਚ ਫੋਨ ਕੀਤਾ ਜਾਵੇ ਉਹਨਾਂ ਨੂੰ ਦੱਸਿਆ ਜਾਏ ਕਿ ਸਾਡੀ ਗਆਂਢ ਵਿੱਚ ਕੂੜਾ ਬਹੁਤ ਪਿਆ ਹੋਇਆ ਹੈ ਕੋਈ ਕਰਮਚਾਰੀ ਭੇਜ ਕੇ ਉ ਉਹਨੂੰ ਸਾਫ ਸੁਥਰਾ ਕਰਨ ਦੀ ਕਿਰਪਾਲਤਾ ਕਰਨ ਤਾਂ ਕਿ ਅਸੀਂ ਬਿਮਾਰੀਆਂ ਤੋਂ ਬਚੇ